ਕੁਝ ਸਾਲ ਪਹਿਲਾਂ ਮੇਰੇ ਕੋਲ਼ ਨੋਕੀਆ ਗਿਆਰ੍ਹਾਂ ਦਾ ਇੱਕ ਫੋਨ ਹੁੰਦਾ ਸੀ ਬਟਨਾਂ ਵਾਲਾ ਜਿਸ ਵਿੱਚ ਇੱਕ ਸਿੰਮ ਹੁ ਪੈਂਦਾ ਸੀ ਨਾ ਹੀ ਫੋਟੋ ਖਿੱਚ ਹੁੰਦੀ ਸੀ ਅਤੇ ਨਾ ਹੀ ਨੈੱਟ ਚੱਲਦਾ ਸੀ ਹੁਣ ਜਦੋਂ ਦਾ ਮੈਂ ਸੈਮਸੰਗ ਦਾ ਨਵਾਂ ਫੋਨ ਲਿੱਤਾ ਹੈ ਟੱਚ ਸਕਰੀਨ ਵਾਲਾ ਉਦੋਂ ਦਾ ਨੈੱਟ ਵੀ ਚੱਲਦਾ ਹੈ ਅਤੇ ਫੋਟੋਆਂ ਵੀ ਖਿੱਚ ਹੁੰਦੀਆਂ ਹਨ ਨਾਲੇ ਬੱਚੇ ਪੜ੍ਹਾਈ ਵੀ ਕਰ ਸਕਦੇ ਹਨ ਬਹੁਤ ਵਧੀਆ ਨੈੱਟ ਚੱਲਦਾ ਹੈ ਜੀਓ ਦਾ ਮ ਮ ਸਿੰਮ ਇਸ ਵਿੱਚ ਜੀਓ ਦਾ ਸਿੰਮ ਹੈ ਗੂਗਲ ਪੇ ਗੂਗਲ ਪੇਮੈਂਟ ਕਰਕੇ ਇਸ ਵਿੱਚ ਅਸੀਂ ਤਿੰਨ ਮਹੀਨੇ ਵਾਲਾ ਛੇ ਸੌ ਛਿਆਹਠ ਦਾ ਤਿੰਨ ਮਹੀਨੇ ਦਾ ਨੈੱਟ ਪੈਕ ਪਵਾ ਲੈਂਦੇ ਹਾਂ